ਅਸੀਂ ਇੱਕ ਨਵੇਂ ਸ਼ਹਿਰ ਵਿੱਚ ਆਪਣਾ ਘਰ ਲੈ ਲਿਆ ਹੈ ਅਸੀਂ ਬਰਨਾਲਾ ਮਾਡਲ ਟਾਊਨ ਵਿੱਚ ਰਹਿਣ ਲੱਗ ਪਏ ਹੈ ਇੱਥੇ ਸਾਨੂੰ ਇੱਕ ਨਵੇਂ ਬਰੋਡਬੈਂਡ ਕਨੈਕਸ਼ਨ ਦੀ ਜਰੂਰਤ ਹੈ ਸਾਡੇ ਸ਼ਹਿਰ ਵਿੱਚ ਬਰੋਡਬੈਂਡ ਅਸੀਂ ਲਗਵਾਉਣਾ ਚਾਹੁੰਦੇ ਆ ਕਿਉਂਕਿ ਅਸੀਂ ਇੱਕ ਨਵਾਂ ਪਾਰਟਮੈਂਟ ਵਿੱਚ ਆਏ ਹਾਂ ਜਦਕਿ ਇੱਥੇ ਸਾਨੂੰ ਨੈੱਟ ਦੀ ਬਹੁਤ ਜਿਆਦਾ ਜਰੁਰਤ ਹੁੰਦੀ ਹੈ ਤੇ ਨੈਟ ਬਿਨਾ ਅੱਜ ਕੱਲ ਕੁਛ ਵੀ ਨਹੀਂ ਹੁੰਦਾ ਤੇ ਅਸੀਂ ਇੱਕ ਬਰੋਡਬੈਂਡ ਲੈਣਾ ਚਾਹੁੰਦੇ ਹੈ ਜਿਸ ਨਾਲ ਸਾਡਾ ਨਵੇਂ ਹਾਊਸ ਵਿੱਚ ਵਧੀਆ ਤਰੀਕੇ ਕਾਂਫਰਟੇਬਲ ਰਹੀ ਅਸੀਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕੀ ਸਾਡੇ ਘਰ ਨੰਬਰ ਮਾਡਲ ਟਾਊਨ ਹੰਢਾਏ ਵਿਚ ਇੱਕ ਨਵਾਂ ਬਰੋਡਬੈਂਡ ਲੈਣ ਦੀ ਪੇਸ਼ ਕੀਤਾ ਹੋਇਆ ਅਸੀਂ ਸੋਡੇ ਪਿਛਲੀ ਸਰਵਿਸ ਬਹੁਤ ਹੀ ਜ਼ਿਆਦਾ ਖੁਸ਼ ਹੈ ਜਿਸ ਕਰਕੇ ਅਸੀਂ ਸੋਡੇ ਤੋਂ ਹੀ ਦੁਬਾਰਾ ਲਗਵਾਉਣਾ ਚਾਹੁੰਦੇ ਹਾਂ ਕਿਉਂਕੀ ਸੋਡੀ ਸੇਵਾ ਤੋਂ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਜਿਸ ਕਰਕੇ ਅਸੀਂ ਸਿਰਫ ਸੋਡੇ ਸੰਸਥਾ ਨਾਲ ਹੀ ਜੁੜੇ ਹਾਂ ਤੇ ਸੋਡੀ ਸੰਸਥਾ ਬਹੁਤ ਸਮੇਂ ਤੋਂ ਅਜੋਜਿਤ ਕਰ ਕਰਦੇ ਹਾਂ ਜਿਸ ਕਾਰਨ ਅਸੀਂ ਚਾਹਾਂਗੇ ਸਾਡੇ ਇਸ ਨਵੇਂ ਘਰ ਵਿੱਚ ਵੀ ਆਪਣਾ ਬਣਾਉਣ ਸਥਾਪਿਤ ਕਰਨ ਵਿੱਚ ਹੈਲਪ ਕਰੋ